ਹਾਂਜੀ ਭੈਣ ਜੀ ਤੁਸੀਂ ਠੀਕ ਹੋ ਮੈਂ ਸੁਣਿਆ ਕਿ ਇੱਥੇ ਸਿਹਤ ਮੇਲਾ ਤੁਸੀਂ ਲਗਾ ਰਹੇ ਹੋ ਵੀ ਕਾਹਦੇ ਵਾਸਤੇ ਲਗਾ ਰਹੇ ਕਿਹੜੀ ਕਿਹੜੀ ਬਿਮਾਰੀਆਂ ਵਾਸਤੇ ਲਗਾ ਰਹੇ ਹੋ ਇਸ ਕਰਕੇ ਸਾਨੂੰ ਪਤਾ ਹੋਵੇ ਅਸੀਂ ਸਾਡੇ ਵੀ ਇਧਰ ਕਾਫੀ ਏਰੀਏ 'ਚ ਇਸ ਪ੍ਰੋਬਲਮ ਆ ਜਿੱਦਾਂ ਉਹ ਕਾਫੀ ਹੈਗੇ ਨੇ ਬਿਮਾਰ ਅਤੇ ਉਹਨਾਂ ਨੇ ਵੀ ਆਪਣਾ ਇਲਾਜ ਕਰਵਾਉਣਾ ਤਾਂ ਇਸ ਕਰਕੇ ਸਾਨੂੰ ਦੱਸ ਦਓ ਕਿਸ ਟਾਈਮ ਤੁਸੀਂ ਆਉਣਾ ਹੈ ਕਦੋਂ ਲਗਾਉਣਾ ਹੈ ਤਾਂ ਅਸੀਂ ਉਹਨਾਂ ਨੂੰ ਵੀ ਬੁਲਾ ਲਵਾਂਗੇ ਉਸ ਟਾਈਮ 'ਤੇ ਉਹਨਾਂ ਆਪਣਾ ਫੋਨ ਨੰਬਰ ਸਾਨੂੰ ਜੋ ਵੀ ਹੈਗਾ ਦੇ ਦਿਓ ਤਾਂ ਅਸੀਂ ਉਸ ਟਾਈਮ ਉਹਨਾਂ ਨੂੰ ਬੁਲਾ ਲਵਾਂਗੇ ਜਿੱਦਾਂ ਜਿੱਦਾਂ ਵੀ ਤੁਸੀਂ ਕਿਹੜੇ ਕਿਹੜੇ ਡਾਕਟਰਾਂ ਨੇ ਆਉਣਾ ਹੈ ਕਿੱਦਾਂ ਕਿੱਦਾਂ ਤੁਸੀਂ ਆਪਣਾ ਅਰੇਂਜਮੈਂਟ ਕਰਨਾ ਵਾ ਸਾਰਾ ਕੁਛ ਸਾਨੂੰ ਉਸ ਪ੍ਰੋਬਲਮ ਬਾਰੇ ਸਾਨੂੰ ਦੱਸ ਦਿਓ ਅਸੀਂ ਆਪਣੇ ਇਧਰੋਂ ਬੁਲਾ ਕੇ ਰੱਖਾਂਗੇ ਤੁਸੀਂ ਸਾਨੂੰ ਆਪਣਾ ਨੰਬਰ ਸਭ ਕੁਝ ਦੇ ਦਿਓ ਡਰੈਸ ਜਿਸ ਕਰਕੇ ਸਾਨੂੰ ਉਹਨਾਂ ਦਾ ਵੀ ਇਲਾਜ ਕਰਵਾਉਣਾ ਅਸੀਂ